ਕਪੂਰਥਲੇ ਜ਼ਿਲ੍ਹੇ ਵਿੱਚ ਜ਼ਿਆਦਾਤਰ ਹਰ ਤਰੀਕੇ ਦੇ ਤਿਉਹਾਰ ਜਾਂ ਸਮਾਗਮ ਕਰਵਾਏ ਜਾਂਦੇ ਹਨ ਜਿਵੇਂ ਵਿਸਾਖੀ ਹੋ ਗਈ ਜਿਵੇਂ ਲੋਹੜੀ ਹੋ ਗਈ ਜਿਵੇਂ ਦਿਵਾਲੀ ਈਦ ਨਗਰ ਕੀਰਤਨ ਬੁੱਧ ਪੂਰਨਿਮਾ ਹਰ ਤਰੀਕੇ ਦਾ ਤਿਉਹਾਰ ਮਨਾਇਆ ਜਾਂਦਾ ਵਾ ਅਤੇ ਤਿਉਹਾਰ ਹੁੰਦਾ ਕੀ ਆ ਤਿਉਹਾਰ ਜ਼ਿਆਦਾਤਰ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਲੋਕਾਂ ਵਿੱਚ ਖੁਸ਼ੀਆਂ ਵੰਡਣ ਵਾਸਤੇ ਜਾਂ ਕਿਸੀ ਬੰਦੇ ਕਿਸੀ ਪੂਰਵਜ ਵਾਸਤੇ ਮਨਾਇਆ ਜਾਂਦਾ ਵਾ ਜਿਹਨਾਂ ਨੇ ਮਿਹਨਤ ਕਰਕੇ ਕੁਝ ਉਖਾੜਿਆ ਸੀਗਾ ਅਤੇ ਸਾਨੂੰ ਸੁਖ ਪ੍ਰਾਪਤੀ ਹੋਈ ਉਹਦੇ ਨਾਲ ਉਹਨਾਂ ਵਾਸਤੇ ਇੱਕ ਤਿਉਹਾਰ ਮਨਾਇਆ ਜਾਂਦਾ ਵਾ ਜਾਂ ਫਿਰ ਜ਼ਿਆਦਾਤਰ ਲੋਕਾਂ ਦੇ ਵਿੱਚ ਖੁਸ਼ੀਆਂ ਵੰਡਣ ਵਾਸਤੇ ਲੋਕਾਂ ਨੂੰ ਨਾਲ ਰੱਖਣ ਵਾਸਤੇ ਇੱਕ ਵਧੀਆ ਇੱਕ ਵਧੀਆ ਜਿਹਾ ਇਨਵਾਇਰਮੈਂਟ ਬਣਾਉਣ ਵਾਸਤੇ ਬਨ ਲੋਕਾਂ ਨੂੰ ਬਿਠਾਇਆ ਜਾਂਦਾ ਵਾ ਉਹਦੇ ਵਾਸਤੇ ਤਿਉਹਾਰ ਮਨਾਏ ਜਾਂਦੇ ਹਨ ਜ਼ਿਆਦਾਤਰ ਇੱਕ ਕੁਛ ਕੁ ਜਿੰਨੇ ਤਿਉਹਾਰ ਆਉਂਦੇ ਆ ਉਹ ਸਾਰੇ ਹਰ ਸਾਲ ਵੱਖਰੇ ਵੱਖਰੇ ਡੇਟਾਂ ਨੂੰ ਕੱਢੇ ਆ ਵੱਖਰੇ ਵੱਖਰੇ ਅਤੇ ਮਿਤੀ ਨੂੰ ਕਦੇ ਕੱਢੇ ਜਾਂਦੇ ਬਟ ਪਰ ਕੁਛ ਤਿਉਹਾਰ ਜਿਵੇਂ ਲੋਹੜੀ ਹੋ ਗਈ ਲੋਹੜੀ ਹਰ ਸਾਲ ਤੇਰਾਂ ਜਨਵਰੀ ਨੂੰ ਨਹੀਂ ਮਨਾਈ ਜਾਂਦੀ ਹੈ ਹੋਰ ਕੋਈ ਦਿਨ ਨਹੀਂ ਕੱਢਿਆ ਜਾਂਦਾ ਪਰ ਵਿਸਾਖੀ ਹੋ ਗਈ ਈਦ ਹੋ ਗਈ ਜਾਂ ਫਿਰ ਕੀ ਕਹਿੰਦੇ ਆ ਉਹਨੂੰ ਦਿਵਾਲੀ ਹੋ ਗਈ ਉਹ ਹਰ ਸਾਲ ਕਿਸੇ ਵੱਖਰੀ ਵੱਖਰੀ ਡੇਟਾਂ ਨੂੰ ਵੱਖਰੀ ਵੱਖਰੀ ਮਿਤੀ ਨੂੰ ਹੀ ਕੱਢੀਆ ਜਾਂਦੀਆਂ ਹਨ ਇਹ ਇਸ ਦੌਰਾਨ ਇਹਨਾਂ ਤਿਉਹਾਰਾਂ ਦੌਰਾਨ ਅਸੀਂ ਵੱਖ ਵੱਖ ਚੀਜ਼ਾਂ ਖਾਂਦੇ ਹਾਂ ਵੱਖ ਵੱਖ ਚੀਜ਼ਾਂ ਕਰਦੇ ਹਨ ਜਿੱਦਾਂ ਵਿਸਾਖੀ ਦੇ ਟਾਈਮ 'ਤੇ ਅਸੀਂ ਪਤੰਗ ਉੜਾਉਂਦੇ ਹਨ ਅਤੇ ਇਵੇਂ ਅਤੇ ਲੋਹੜੀ ਦੇ ਟਾਈਮ 'ਤੇ ਵੀ ਅਸੀਂ ਲੋਹੜੀ ਤੋਂ ਲੈ ਕੇ ਵਿਸਾਖੀ ਤੱਕ ਅਸੀਂ ਪਤੰਗਾ ਹੀ ਉਡਾਉਂਦੇ ਰਹਿੰਦੇ ਹਨ ਲੋਹੜੀ ਦੇ ਟਾਈਮ 'ਤੇ ਅਸੀਂ ਅੱਗ ਰਾਤ ਦੇ ਟਾਈਮ 'ਤੇ ਅੱਗ ਬਾਲਦੇ ਹਨ ਅਤੇ ਇੱਕ ਪੱਕੀ ਚੀਜ਼ ਹੈ ਕਿ ਰਾਤ ਦੇ ਟਾਈਮ 'ਤੇ ਬਾਰਿਸ਼ ਹੋਣੀ ਹੋਣੀ ਆ ਮਾੜੀ ਜਿਹੀ ਵਿਸਾਖੀ ਦੇ ਟਾਈਮ 'ਤੇ ਖੇਤਾਂ ਵਿੱਚ ਫਸਲ ਵਗੈਰਾ ਕੱਟੀ ਜਾਂਦੀ ਹੈ ਸਾਰੇ ਇਕੱ ਸਮਾਨ ਇਕੱਠਾ ਕੀਤਾ ਜਾਂਦਾ ਜਿਹੜਾ ਸਾਰੇ ਸਰਦੀਆਂ ਵਾਸਤੇ ਲਾਇਆ ਹੋਇਆ ਸੀ ਅਤੇ ਪੀਲੇ ਰੰਗ ਦੇ ਚਾਵਲ ਖਾਏ ਜਾਂਦੇ ਹਨ ਦਿਵਾਲੀ 'ਤੇ ਅਸੀਂ ਪਟਾਕੇ ਫੋੜਦੇ ਹਨ ਅਤੇ ਲਕਸ਼ਮੀ ਪੂਜਾ ਕਰਵਾਈ ਜਾਂਦੀ ਹੈ ਅਤੇ ਵੱਖਰੀਆ ਵੱਖਰੀਆਂ ਚੀਜ਼ਾਂ ਹੁੰਦੀਆਂ ਹਨ